ਪੰਜਾਬੀ ਭਾਸ਼ਾ ਦੀ ਤੁਲਨਾ ਕਿਸੇ ਹੋਰ ਭਾਸ਼ਾ ਨਾਲ਼ ਨਹੀਂ ਕੀਤੀ ਜਾ ਸਕਦੀ ਕਿਉਂਕਿ ਪੰਜਾਬੀ ਭਾਸ਼ਾ ਆਪਣੇ ਆਪ ਵਿੱਚ ਹੀ ਅਮੀਰ ਭਾਸ਼ਾ ਹੈ ਮੰਨ ਲਓ ਕਿ ਮੈਂ ਅੰਗਰੇਜ਼ੀ ਹਿੰਦੀ ਭਾਸ਼ਾ ਜਾਣਦੀ ਹਾਂ ਪਰ ਸਾਡੀ ਪੰਜਾਬੀ ਭਾਸ਼ਾ ਇਹਨਾਂ ਭਾਸ਼ਾਵਾਂ ਨਾਲ਼ੋਂ ਹਟਕੇ ਹੈ ਇਹ ਸਾਡੀ ਮਾਤ ਭਾਸ਼ਾ ਹੈ ਅੱਜ ਕੱਲ੍ਹ ਲੋਕ ਇੰਗਲਿਸ਼ ਬੋਲਣਾ ਬਹੁਤ ਚੰਗਾ ਸਮਝਦੇ ਹਨ ਉਹ ਸਮਝਦੇ ਹਨ ਕਿ ਜੋ ਇੰਗਲਿਸ਼ ਬੋਲਦੇ ਹਨ ਉਹਨਾਂ ਦਾ ਸਟੇਟਸ ਬਹੁਤ ਉੱਚਾ ਹੈ ਜਦਕਿ ਉਹੀ ਅਗਰ ਆਪਾਂ ਪੰਜਾਬੀ ਦੀ ਤੁਲਨਾ ਕਰੀਏ ਤਾਂ ਲੋਕ ਪੰਜਾਬੀ ਭਾਸ਼ਾ ਨੂੰ ਭੈੜਾ ਸਮਝਦੇ ਹਨ ਉਹਨਾਂ ਨੂੰ ਪੰਜਾਬੀ ਬੋਲਣ ਲੱਗੇ ਸ਼ਰਮ ਆਉਂਦੀ ਹੈ ਜਦਕਿ ਅਜਿਹਾ ਨਹੀਂ ਹੈ ਅਗਰ ਪੰਜਾਬੀ ਭਾਸ਼ਾ ਨੂੰ ਸਰਲਤਾ ਨਾਲ਼ ਬੋਲਿਆ ਜਾਵੇ ਤਾਂ ਪੰਜਾਬੀ ਭਾਸ਼ਾ ਵੀ ਵਧੀਆ ਲੱਗਦੀ ਹੈ ਅੱਜ ਕੱਲ੍ਹ ਤਾਂ ਪੰਜਾਬੀਆਂ ਨੇ ਪੰਜਾਬੀ ਭਾਸ਼ਾ ਨੂੰ ਬਹੁਤ ਉੱਚ ਸਿਖਰ 'ਤੇ ਪਹੁੰਚਾਇਆ ਹੈ ਅੱਜ ਕੱਲ੍ਹ ਤਾਂ ਫੌਰਨ ਕੰਟਰੀਆਂ ਵਿੱਚ ਵੀ ਲੋਕ ਪੰਜਾਬੀ ਬੋਲਦੇ ਹਨ ਜੇਕਰ ਹਿੰਦੀ ਭਾਸ਼ਾ ਨਾਲ਼ ਪੰਜਾਬੀ ਭਾਸ਼ਾ ਦੀ ਤੁਲਨਾ ਕਰੀਏ ਤਾਂ ਹਿੰਦੀ ਆਪਣੇ ਆਪ ਵਿੱਚ ਇੱਕ ਬਹੁਤ ਵਧੀਆ ਭਾਸ਼ਾ ਹੈ ਪਰ ਉਸ ਦੀ ਤੁਲਨਾ ਪੰਜਾਬੀ ਨਾਲ਼ ਨਹੀਂ ਕੀਤੀ ਜਾ ਸਕਦੀ ਕਿਉਂਕਿ ਪੰਜਾਬੀ ਸਾਡੀ ਮਾਤ ਭਾਸ਼ਾ ਹੈ ਸਾਡੀ ਗੁਰਮੁਖੀ ਸਾਨੂੰ ਸਾਡੇ ਗੁਰੂ ਸਾਹਿਬਾਨਾਂ ਤੋਂ ਮਿਲੀ ਹੈ ਹਰ ਦੇਸ਼ ਦੀ ਭਾਸ਼ਾ ਆਪਣੇ ਆਪ ਵਿੱਚ ਬਹੁਤ ਵਧੀਆ ਹੈ ਪਰ ਮੈਂ ਪੰਜਾਬੀ ਹਾਂ ਅਤੇ ਮੈਨੂੰ ਆਪਣੀ ਪੰਜਾਬੀ ਭਾਸ਼ਾ ਉੱਤੇ ਮਾਣ ਹੈ ਧੰਨਵਾਦ